ਉਨ੍ਹਾਂ ਦੇ ਕਰਜ਼ੇ ਮਾਫ ਕਰ ਦੇਣੇ ਚਾਹੀਦੇ ਹਨ ਜਿਸ ਨਾਲ ਉਹ ਆਪਣੀ ਜ਼ਿੰਦਗੀ ਜੀਅ ਸਕਣ ਨਾ ਕੇ ਡਿਪਰੈਸ਼ਨ ਵਾਲੀ ਜ਼ਿੰਦਗੀ ਜੀਅ ਸਕਣ ਅਤੇ ਅਤੇ ਕਿਸ ਕਰ ਕਰਜ਼ਾ ਮਾਫ ਕਰ ਦੇਣਾ ਚਾਹੀਦਾ ਹੈ ਅਤੇ ਜਿਸ ਨਾਲ ਉਹ ਜਿਸ ਨਾਲ ਜਿਸ ਨਾਲ ਉਹ ਖੁਦਕੁਸ਼ੀ ਨਾ ਕਰ ਸਕਣ